ਭੰ ਭੰਗੜਾ ਪੰਜਾਬ ਦਾ ਇੱਕ ਲੋਕ ਨਿ ਨ੍ਰਿਤ ਹੈ ਜੋ ਕਿ ਅਸੀਂ ਪੰਜਾਬ 'ਚ ਖੁਸ਼ੀ ਅਤੇ ਖੇੜੇ ਕਰਕੇ ਮਤਬਲ ਪਾਉਂਦੇ ਹਾਂ ਜਵਾ ਜਿਵੇਂ ਕਿਸੇ ਦੇ ਘਰ ਬੱਚਾ ਹੋ ਗਿਆ ਤਾਂ ਭੰਗੜਾ ਪਾ ਲਓ ਕਿਤੇ ਲੋਹੜੀ 'ਤੇ ਕਿਤੇ ਫ ਵਿਆਹ 'ਤੇ ਸ਼ਾਦੀਆਂ 'ਤੇ ਭੰਗੜੇ ਦਾ ਉਤਸ਼ਾਹ ਵਿਖਾ ਵੇਖਣ ਮਿਲਦਾ ਹੈ ਕਿਉਂਕਿ ਭੰਗੜਾ ਇੱਕ ਪੰਜਾਬੀ ਲੋਕ ਨਾਚ ਹੈ ਜਿਸ ਜੋ ਪੰਜਾਬੀ ਇਸ ਨੂੰ ਢੋਲ 'ਤੇ ਚਿਮਟਿਆਂ ਨਾਲ ਪਾਉਂਦੇ ਹਨ ਅਤੇ ਇਹਦੇ ਨਾਲ ਇੱਕ ਸਰੀਰ ਦੀ ਇੱਕ ਫਿਟਨੈਸ ਵੀ ਬਣੀ ਰਹਿੰਦੀ ਹੈ ਭੰਗੜਾ ਪਾਉਣਾ ਇੱਕ ਖੁਸ਼ੀ ਦਰਸਾਉਣਾ ਹੈ ਕਿਉਂਕਿ ਪੰਜਾਬ ਸਟੇਟ ਪੰਜਾਬੀ ਲੋਕ ਗੀਤਾਂ ਦੇ ਵਿੱਚ ਮਾਹੌਲ ਬਹੁਤ ਜ਼ਿਆਦਾਤਰ ਭੰਗੜੇ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਭੰਗੜਾ ਉਤਸ਼ਾਹਿਤ ਅਤੇ ਓ ਹਰਲ ਉੱਲਾਸ ਨਾਲ ਹੀ ਪਾਇਆ ਜਾਂਦਾ ਹੈ ਜਿਸ ਨਾਲ ਇਸ ਭੰਗੜੇ ਨੂੰ ਢੋਲ ਥੱਬਿਆਂ ਨਾਲ ਹੀ ਪਾਇਆ ਪਾ ਕੇ ਲੋਕ ਜਿਵੇਂ ਵਿਸਾਖੀ ਦੇ ਮੇਲੇ ਵਿੱਚ ਭੰਗੜਾ ਪਾਉਣਾ ਅਤੇ ਕਿਸੇ ਵੀ ਸ਼ਾਦੀ 'ਤੇ ਭੰਗੜਾ ਸਾਮਾਰੋਹ ਵਿੱਚ ਕਈ ਗੀਤ ਵੀ ਜ਼ਿਆਦਾਤਰ ਭੰਗੜੇ 'ਤੇ ਹੀ ਪਾਏ ਜਾਂਦੇ ਨੇ ਭੰਗੜਾ ਇਸ ਖੁਸ਼ੀ ਦਾ ਮੁੱਖ ਕਾਰਨ ਹੈ ਭੰਗੜਾ ਦੇ ਲਈ ਉਤਸ਼ਾਹ ਅਤੇ ਵਿੱਚ ਮਨਾਇਆ ਜਾ ਪਾਇਆ ਜਾਂਦਾ ਹੈ